ਪੰਜਾਬ ਦੇ ਮੁੱਖ ਕੁਦਰਤੀ ਸਰੋਤ ਹੈਗੇ ਆ ਜਿਵੇਂ ਰੇਤਾ ਪਾਣੀ ਬਜਰੀ ਅਤੇ ਇਸ ਤੋਂ ਇਲਾਵਾ ਸਾਡੇ ਜੰਗਲ ਹੈ ਨਾ ਅਤੇ ਵ ਵਾਹਿਗੁਰੂ ਦੀ ਬਖਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਪਾਣੀ ਭਰਪੂਰ ਸੀ ਸੀ ਹੈ ਨਾ ਕਿਉਂਕਿ ਹੁਣ ਜਿਹੜਾ ਪਾਣੀ ਦਾ ਉਹ ਘਟੀ ਜਾ ਰਿਹਾ ਆ ਲੋਕਾਂ ਨੇ ਮਿਸਯੂਸ ਹੀ ਕੀਤਾ ਲੋਕਾਂ ਨਾਲੋਂ ਵੱਧ ਸਰਕਾਰਾਂ ਨੇ ਵੀ ਇਹਦਾ ਮਿਸਯੂਸ ਕੀਤਾ ਪਾਣੀ ਦਾ ਪੰਜਾਬ ਜਿਹੜੀ ਕਿ ਪਹਿਲਾਂ ਪੰਜਾਂ ਪਾਣੀਆਂ ਦੀ ਧਰਤੀ ਸੀਗੀ ਜਿੱਥੇ ਪੰਜ ਦਰਿਆ ਵੱਗਦੇ ਸੀ ਮਾਇਨੇ ਰੱਖਦਾ ਇਹ ਅਤੇ ਪਰ ਅੱਜ ਕੱਲ੍ਹ ਇੱਥੇ ਆਜ਼ਾਦੀ ਦੀ ਵੰਡ ਤੋਂ ਬਾਅਦ ਸਿਰਫ ਤਿੰਨ ਦਰਿਆ ਰਹਿ ਗਏ ਹਾਂ ਅ ਅਤੇ ਪੰਜਾਬ ਦੇ ਵਿੱਚ ਜਮੀਨੀ ਪਾਣੀ ਬਹੁਤ ਵਧੀਆ ਸੀ ਜਿਹੜਾ ਸਾਡੀ ਖੇਤੀਬਾੜੀ ਨੂੰ ਉੱਨਤ ਕਰਦਾ ਸੀ ਜਾਂ ਕੁਝ ਵੀ ਆ ਪਰ ਅੱਜ ਕੱਲ੍ਹ ਬਹੁਤ ਮਿਸਯੂਸ ਹੋਣ ਨਾਲ ਪੰਜਾਬ ਦੇ ਵਿੱਚ ਵੀ ਮਤਲਬ ਸਥਿਤੀ ਜਿਹੜੀ ਆ ਉਹ ਹੌਲੀ ਹੌਲੀ ਸੋਕੇ ਵੱਲ ਨੂੰ ਵੱਧਦੀ ਜਾ ਰਹੀ ਹੈ ਕਿ ਪੰਜਾਬ ਦੀ ਜਮੀਨ ਦੇ ਅੰਦਰੋਂ ਪਾਣੀ ਖਤਮ ਹੋ ਰਿਹਾ ਵਿਗਿਆਨੀ ਵੀ ਚਿੰਤਤ ਅਸੀਂ ਆਮ ਲੋਕ ਵੀ ਚਿੰਤਤ ਹੈਗੇ ਇਸ ਗੱਲ ਨੂੰ ਲੈ ਕੇ ਸੋ ਮਿਸਯੂਸ ਜ਼ਿਆਦਾ ਆ ਜਿਹੜੀ ਸੰਭਾਲ ਨਹੀਂ ਕੀਤੀ ਗਈ ਅਸੀਂ ਅਸੀਂ ਸੰਭਾਲ ਨਹੀਂ ਕੀਤੀ ਅਸੀਂ ਫੋਲਟੀ ਹਾਂ ਅਸੀਂ ਪੰਜਾਬੀ ਲੋਕ ਇਸ ਤੋਂ ਇਲਾਵਾ ਵੱਧ ਤੋਂ ਵੱਧ ਅਸੀਂ ਰੇਤਾ ਕੱਢ ਰਹੇ ਹਾਂ ਜਿਵੇਂ ਉਹ ਅਸੀਂ ਜਮੀਨ ਨੂੰ ਖਰਾਬ ਕਰੀ ਜਾ ਰਹੇ ਹਾਂ ਸੋ ਅਸੀਂ ਜ਼ਿਆਦਾ ਮਿਸਯੂਸ ਹੀ ਕੀਤਾ ਇਹਦਾ